ਕਿਤਾਬਾਂ ਤੋਂ ਇਲਾਵਾ ਮੈਂ ਪੰਜਾਬੀ ਟਰੈਵਲ ਕਪਲ ਦਾ ਡੇਲੀ ਵਲੋਗ ਦੇਖਦੀ ਹਾਂ ਹੁਣੇ ਹੁਣੇ ਰੀਸੈਂਟਲੀ ਜਿਹੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵਿਜਿਟ ਕੀਤਾ ਅਤੇ ਉੱਥੇ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਪਾਕਿਸਤਾਨ ਦੇ ਪਿੰਡਾਂ ਦੇ ਵਿੱਚ ਕਿਵੇਂ ਲੋਕਾਂ ਦੀ ਨੋਰਮਲ ਜਿੰਦਗੀ ਆ ਉਹਦੇ ਬਾਰੇ ਸਾਨੂੰ ਦਿਖਾਇਆ ਅਤੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਸਾਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਨਾਂ ਦਾ ਇਹ ਵਲੋਗ ਅਤੇ ਉੱਥੇ ਉਹਨਾਂ ਨੇ ਜਿਵੇਂ ਲਾਹੌਰ ਦੇ ਬਾਜ਼ਾਰਾਂ ਵਿੱਚ ਵੀ ਵਿਜਿਟ ਕੀਤਾ ਉੱਥੋਂ ਬਾਰੇ ਸਾਰੀ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਵਿਜਿਟ ਕੀਤਾ ਅਤੇ ਉਹਦੇ ਵਲੋਗ ਸਾਨੂੰ ਦਿਖਾਏ ਆ ਜਿਵੇਂ ਕਿ ਅਫੈਰੀਕਾ ਦੇ ਵਿਚ ਉਨ੍ਹਾਂ ਨੇ ਪਿੱਛੇ ਜਿਹੇ ਵਿਜ਼ਿਟ ਕੀਤਾ ਸੀ ਦੁਬਈ ਦੇ ਵਿਚ ਵਿਜ਼ਿਟ ਕੀਤਾ ਅਤੇ ਹੋਰ ਵੀ ਕਾਫ਼ੀ ਦੇਸ਼ਾਂ ਦੇ ਵਿਚ ਉਹ ਘੁੰਮੇ ਨੇ ਅਤੇ ਉਥੋਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਨਾਂ ਦਾ ਵਲੋਗ ਇਸ ਤੋਂ ਵ ਇਲਾਵਾ ਮੈ ਇੰਦਰ ਅਤੇ ਕੀਰਤ ਦੇ ਵਲੋਗ ਵੀ ਦੇਖਦੀ ਹਾਂ ਅਤੇ ਉਹ ਵੀ ਆਸਟ੍ਰੇਲੀਆ ਦੇ ਵਿਚ ਰਹਿੰਦੇ ਨੇ ਉੱਥੋਂ ਦੀ ਜਿੰਦਗੀ ਬਾਰੇ ਅਤੇ ਜਦੋਂ ਪੰਜਾਬ ਵਿਜ਼ਿਟ ਕਰਦੇ ਨੇ ਤਾਂ ਪੰਜਾਬ ਦੇ ਬਾਰੇ ਸਾਨੂੰ ਦੱਸਦੇ ਰਹਿੰਦੇ ਨੇ ਗੇ ਇਸ ਤੋਂ ਇਲਾਵਾ ਮੈਂ ਡੇਲੀ ਜਿਹੜਾ ਗਾ ਦਾ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਨਿਊਜ਼ਪੇਪਰ ਪੜ੍ਹਦੀ ਹੈਗੀ ਅਤੇ ਉਹਦੇ ਵਿਚ ਜਿਹੜਾ ਉਨ੍ਹਾਂ ਦਾ ਆਰਟੀਕਲ ਸੈਕਸ਼ਨ ਹੁੰਦਾ ਉਹਨੂੰ ਡੇਲੀ ਮੈਂ ਪੜ੍ਹਦੀ ਹਾਂ ਅਤੇ ਜਿਹੜਾ ਯੂਨੀਵਰਸਿਟੀ ਨਿਊਜ਼ ਦਾ ਮੈਗਜੀਨ ਆ ਉਹਨੂੰ ਵੀ ਮੈਂ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਦੀ ਹਾਂ